ਜਾ ਮੈਨੂੰ ਪੰਜ ਤਰੀਕਾਂ ਹਮੇਸ਼ਾ ਯਾਦ ਰਹਿੰਦੀਆਂ ਸਾਲ ਦੀਆਂ ਇੱਕ ਮੇਰਾ ਬਰਡੇ ਛੇ ਸਤੈਬਰ ਨੂੰ ਜਿਹੜਾ ਹੁੰਦਾ ਇੱਕ ਮੇਰਾ ਹਸਬੈਂਡ ਦਾ ਬਰਡੇ ਜਿਹੜਾ ਅਠਾਈ ਜਨਵਰੀ ਨੂੰ ਹੁੰਦਾ ਫਿਰ ਮੇਰੀ ਵੱਡੀ ਕੁੜੀ ਦਾ ਜਨਮਦਿਨ ਜਿਹੜਾ ਕਿ ਸੱਤ ਸਤੈਬਰ ਨੂੰ ਹੁੰਦਾ ਅਤੇ ਮੇਰੀ ਛੋਟੀ ਕੁੜੀ ਦਾ ਜਨਮ ਦਿਨ ਜਿਹੜਾ ਕਿ ਚੌਦਾਂ ਅਪ੍ਰੈਲ ਨੂੰ ਹੁੰਦਾ ਉਸ ਤੋਂ ਇਲਾਵਾ ਮੈਨੂੰ ਆਪਣੀ ਵਿਆਹ ਦੀ ਸਾਲਗਿਰਾ ਨੀ ਭੁੱਲਦੀ ਜੋ ਕਿ ਸਾਡੀ ਹੁੰਦੀ ਹੈ ਬਾਰਾਂ ਅਕਤੂਬਰ ਦੀ